ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਕਿਹੜੀ ਗੱਡੀ ਲੈਣੀ ਹੈ ਜੀ ਇਨੋਵਾ ਮਿਲ ਜੂਗੀ ਦਿੱਲੀ ਨੰਬਰ ਕਿਹੜਾ ਮੋਡਲ ਚਾਹੀਦਾ ਜੀ ਸੋਲ੍ਹਾਂ ਮੋਡਲ ਮਿਲ ਜੂਗਾ ਭਾਅ ਜੀ ਆ ਜੋ ਜਦ ਮਰਜ਼ੀ ਵਿਜ਼ਿਟ ਕਰ ਲਉ ਆ ਜੋ ਭਾਅ ਜੀ ਅਲੱਗ ਅਲੱਗ ਹੈ ਹਰੇਕ ਦਾ ਕੋਈ ਜੀ ਮੋਡਲ ਹੈ ਕੋਈ ਜੇ ਫੋਰ ਮੋਡਲ ਹੈ ਕੋਈ ਜੈਡਐਕਸ ਮੋਡਲ ਹੈ ਹੋਰ ਮੋਡਲ ਵੀ ਖੜ੍ਹੀਆਂ ਆਪਣੇ ਕੋਲ ਸਾਫ ਗੱਡੀਆਂ ਖੜ੍ਹੀਆਂ ਬਿਲਕੁਲ ਦਿੱਲੀ ਮੋਡਲ ਸ਼੍ਰੀ ਰਾਮ ਫਾਈਨਾਸ ਆਪਣੇ ਕੋਲ ਲੋਕਲ ਫਾਈਨਾਸ ਹੈਗੇ ਹੈ ਜੀ ਅਸੀਂ ਖੁਦ ਵੀ ਫਾਈਨਾਸ ਕਰਦੇ ਹੈ ਜਿਹੜਾ ਤਾਂ ਸ਼੍ਰੀ ਰਾਮ ਹੈ ਉਹਦਾ ਤਾਂ ਹੈਗਾ ਜੀ ਵੀ ਤਕਰੀਬਨ ਸਾਢੇ ਕੁ ਦਸ ਪ੍ਰਸੈਂਟ ਆ ਜੇ ਹੈਗੇ ਏ ਜੀ ਸਿਬਲ ਵਗੈਰਾ ਚੈੱਕ ਕਰਦੇ ਹੈ ਜੇ ਸਿਬਲ ਵਗੈਰਾ ਬਹੁਤਾ ਜ਼ਿਆਦਾ ਖਰਾਬ ਹੈ ਕੋਈ ਦੋ ਗਰੰਟਰ ਚਾਹੀਦੇ ਆਪਣੇ ਕੋਲ ਅਤੇ ਚੈੱਕ ਵਗੈਰਾ ਚਾਹੀਦੇ ਗਰੰਟਰਾਂ ਲਈ ਅਤੇ ਆਪਾਂ ਲੋਕਲ ਫਾਈਨਾਸ ਕਰ ਡਾਊਨ ਪੇਮੈਂਟ ਭਾਅ ਜੀ ਤੁਸੀਂ ਵੱਧ ਤੋਂ ਵੱਧ ਜਿੰਨੀ ਵੀ ਦੇ ਸਕਦੇ ਹੈ ਜੇ ਤਾਂ ਤੁਸੀਂ ਸ਼੍ਰੀ ਰਾਮ ਤੋਂ ਕਰੋ ਕਰੋਂਗੇ ਤਾਂ ਤਕਰੀਬਨ ਮੰਨ ਲਉ ਸਪੋਸ ਕਰੋ ਜੇ ਸਾਢੇ ਛੇ ਲੱਖ ਦੀ ਗੱਡੀ ਹੈ ਤਾਂ ਡੇਢ ਲੱਖ ਰੁਪਈਆ ਪਹਿਲਾਂ ਡਾਊਨ ਪੇਮੈਂਟ ਕਰਨੀ ਹੈ ਪੰਜ ਲੱਖ ਦਾ ਲੋਨ ਹੋ ਜੂਗਾ ਜੇ ਲੋਕਲ ਫਾਇਨਾਸ ਤੋਂ ਕਰਨੀ ਹੈ ਚਾਹੇ ਤੁਸੀਂ ਚੈੱਕ ਦੇ ਕੇ ਸਕਿਉਰਟੀ ਬੋਂਡ ਭਰ ਕੇ ਤੁਸੀਂ ਲਿਆ ਸਕਦੇ ਹੋ ਕੇ ਵਾਈ ਸੀ ਆਧਾਰ ਕਾਰਡ ਪਰੂਫ ਚਾਹੀਦੇ ਹੈ ਜੀ ਬੈਂਕ ਦੀ ਸਟੇਟਮੈਂਟ ਚਾਹੀਦੀ ਹੈ ਅਤੇ ਦੋ ਗਰੰਟਰ ਚਾਹੀਦੇ ਜਿਹੜੇ ਉਨ੍ਹਾਂ ਦੀ ਆਪਣਾ ਉਨ੍ਹਾਂ ਦੇ ਵੀ ਚੈੱਕ ਚਾਹੀਦੇ ਹੈ ਉਨ੍ਹਾਂ ਦੀ ਵੀ ਸਕਿਉਟੀ ਚੈੱਕ ਰੱਖਾਂਗੇ ਜੀ ਫਿਰ ਦੋ ਚਾਹੀਦੇ ਹੈ ਜੇ ਲੋਕਲ ਫਾਈਨੈਂਸ ਤੋਂ ਕਰਾਉਣਾ ਤਾਂ ਦੋ ਜੇ ਸ਼੍ਰੀ ਰਾਮ ਤੋਂ ਕਰਾਉਣਾ ਤਾਂ ਇੱਕ ਜੀ ਥੈਂਕ ਯੂ ਥੈਂਕ ਯੂ